ਮੈਂ ਰੰਜਨ ਕੁਮਾਰ ਮੈਂ ਕਾਫੀ ਦਿਨਾਂ ਤੋਂ ਇੱਕ ਜੈਕਟ ਪਸੰਦ ਕਰ ਰਿਹਾ ਸੀਗਾ ਮੈਂ ਮੀਸ਼ੋ ਫਲਿੱਪਕਾਰਡ ਐਮਾਜੋਨ 'ਤੇ ਵੀ ਕਾਫੀ ਜੈਕਟਾਂ ਪਸ ਦੇਖੀਆਂ ਮੈਨੂੰ ਕੋਈ ਪਸੰਦ ਨਹੀਂ ਆਈ ਫਿਰ ਮੈਂ ਮੀਸ਼ੋ ਪਰ ਇੱਕ ਮੈਨੂੰ ਜੈਕਟ ਪਸੰਦ ਆਈ ਉਹ ਜੈਕਟ ਲੈਦਰ ਦੀ ਸੀ ਉਹ ਉਹ ਬਲੈਕ ਕਲਰ ਦੀ ਸੀ ਉਹਦਾ ਜਿਹੜਾ ਡਿਜ਼ਾਇਨ ਹੈ ਉਹ ਬਹੁਤ ਪਸੰਦ ਆਇਆ ਮੈਨੂੰ ਫਿਰ ਮੈਂ ਓਹ ਜੈਕਟ ਔਰਡਰ ਕਰਤੀ ਔਰਡਰ ਔਰਡਰ ਬਹੁਤ ਜਲਦੀ ਮੇਰੇ ਕੋਲ ਪਹੁੰਚ ਗਿਆ ਜਿੱਦਾਂ ਹੀ ਮੈਂ ਉਹ ਪੈਕਟ ਖੋਲ੍ਹਿਆ ਔਰਡਰ ਵਾਲਾ ਅਤੇ ਉਹਦੇ ਵਿੱਚ ਜੈਕਟ ਨਿਕਲੀ ਉਹ ਸੇਮ ਉਸ ਕਲਰ ਦੀ ਸੀ ਜਿਸ ਕਲਰ ਦੀ ਮੈਂ ਔਰਡਰ ਕਰਿਆ ਸੀ ਸੇਮ ਸਾਈਜ ਸੀ ਔਰਡਰ ਬਹੁਤ ਵਧੀਆ ਸੀਗਾ ਮੈਂ ਜੈਕਟ ਪਾ ਕੇ ਦੇਖੀ ਬਹੁਤ ਸੋਹਣੀ ਲੱਗਦੀ ਸੀਗੀ ਜੈਕਟ ਜਦੋਂ ਉਹ ਜੈਕਟ ਮੈਂ ਕੋਲੇਜ ਪਾ ਕੇ ਗਿਆ ਕੋਲੇਜ ਜਿਹੜੇ ਮੇਰੇ ਯਾਰ ਦੋਸਤ ਨੇ ਉਹਨਾਂ ਨੇ ਪੁੱਛਿਆ ਕਿ ਵੀ ਜੈਕਟ ਕਿੱਥੋਂ ਲੈ ਕੇ ਆਇਆ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਔਨਲਾਈਨ ਔਰਡਰ ਕਰੀ ਸੀਗੀ ਅਤੇ ਉਹ ਕਹਿੰਦੇ ਸੀਗੇ ਮੈਨੂੰ ਮੇਰੇ ਵਾਸਤੇ ਵੀ ਔਰਡਰ ਕਰ ਦੀ ਜੈਕਟ ਬਹੁਤ ਹੀ ਵਧੀਆ ਸੀਗੀ ਤਾਂ ਮੈਂ ਪਹਿਲੀ ਵਾਰੀ ਔਨਲਾਈਨ ਸ਼ੋਪਿੰਗ ਕੀਤੀ ਸੀਗੀ ਜੈਕਟ ਮੰਗਾਈ ਸੀਗੀ ਜਿਹੜੀ ਸਭ ਤੋਂ ਪਹਿਲੀ ਵਾਰ ਮੈਂ ਔਨਲਾਈਨ ਸ਼ੋਪਿੰਗ ਕੀਤੀ ਸੀਗੀ ਅਤੇ ਮੈਨੂੰ ਜੈਕਟ ਬਹੁਤ ਹੀ ਪਸੰਦ ਆਈ ਅਤੇ ਫਿਰ ਮੈਂ ਅੱਗੇ ਵੀ ਔਨਲਾਈਨ ਸ਼ੋਪਿੰਗ ਕਰਾਂ